ਪੰਦਰ੍ਹਾਂ ਅਗਸਤ ਉੱਨੀ ਸੌ ਪੰਜਾਹ ਛੱਬੀ ਜਨਵਰੀ ਉੱਨੀ ਸੌ ਸੱਠ ਗਿਆਰ੍ਹਾਂ ਦਸੰਬਰ ਉੱਨੀ ਸੌ ਤੇਈ ਇੱਕ ਮਾਰਚ ਦੋ ਹਜ਼ਾਰ ਪੰਜ ਬਾਈ ਅਕਤੂਬਰ ਦੋ ਹਜ਼ਾਰ ਚਾਰ